ਜ਼ਿੰਦਗੀ ਵਿੱਚ ਕਲਾ ਇੱਕ ਬਹੁਤ ਅਹਿਮ ਰੋਲ ਪਲੇਅ ਕਰਦੀ ਹੈ ਜਿਸ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕੀ ਅਸੀਂ ਕਿੰਨੇ ਜ਼ਿਆਦਾ ਗੁਣਵਾਨ ਹਾਂ ਅਤੇ ਸਾਡੀ ਇੱਕ ਸੋਚ ਨੂੰ ਅਸੀਂ ਕਲਾ ਰਾਹੀਂ ਕਿੱਦਾਂ ਪ੍ਰਗਟ ਕਰ ਸਕਦੇ ਹਾਂ ਇੱਕ ਇਨਸਾਨ ਦੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨਾ ਹੀ ਅਸਲ ਵਿੱਚ ਇੱਕ ਕਲਾ ਹੁੰਦੀ ਹੈ ਕਿ ਸਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਜ਼ਿੰਦਗੀ ਵਿੱਚ ਅਸੀਂ ਇਹ ਵੀ ਮਦਦ ਹੁੰਦੀ ਹੈ ਸਾਡੀ ਕੀ ਇੱਕ ਕਲਾ ਰਾਹੀਂ ਅਸੀਂ ਇੱਕ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਇੱਕ ਚੰਗਾ ਜੀਵਨ ਕਿੱਦਾਂ ਬਤੀਤ ਕੀਤਾ ਜਾ ਸਕਦਾ ਹੈ